ਜੇਕਰ ਸਮਾਜ ਵਿੱਚ ਡਾਂਸਰਾਂ ਨੂੰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੀ ਗੱਲ ਕਰੀਏ ਤਾਂ ਪਹਿਲਾਂ ਨਾਲੋਂ ਅੱਜ ਦੇ ਸਮੇਂ ਵਿੱਚ ਉਹ ਮੁਸ਼ਕਿਲਾਂ ਹੁਣ ਨਹੀਂ ਰਹੀਆਂ ਕਿਉਂਕਿ ਪਹਿਲਾਂ ਲੋਕ ਡਾਂਸਿੰਗ ਨੂੰ ਬਹੁਤ ਨੀਵਾਂ ਕਿੱਤਾ ਸਮਝਦੇ ਸੀ ਇਹਨਾਂ ਨੂੰ ਜ਼ਿਆਦਾਤਰ ਬਾਜੀਗਰਾਂ ਦਾ ਹੀ ਕੰਮ ਸਮਝਿਆ ਜਾਂਦਾ ਸੀ ਪਰ ਅੱਜ ਕੱਲ੍ਹ ਦੇ ਸਮਾਜ ਵਿਚ ਡਾਂਸਿੰਗ ਇੱਕ ਕਲਾ ਦੇ ਰੂਪ ਵਿਚ ਹੀ ਦੇਖੀ ਜਾਂਦੀ ਹੈ ਅਤੇ ਇਸ ਲਈ ਇਸ ਸਮਾਜ ਦੇ ਵਿੱਚ ਪਹਿਲਾਂ ਨਾਲੋਂ ਹੁਣ ਇਹਨਾਂ ਲੋਕਾਂ ਨੂੰ ਵੀ ਵਧੀਆ ਦੇਖਿਆ ਜਾਂਦਾ ਅੱਜ ਕੱਲ੍ਹ ਮੁਕਾਬਲੇ ਕਰਵਾਏ ਜਾਂਦੇ ਨੇ ਟੀਵੀ ਚੈਨਲਾਂ 'ਤੇ ਕਿੰਨੇ ਸ਼ੋ ਆ ਰਹੇ ਨੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰੇ ਇਸ ਮੁਕਾਬਲੇ ਦਾ ਹਿੱਸਾ ਬਣਦੇ ਨੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਨੇ ਅਤੇ ਡਾਂਸ ਜਿਹੜਾ ਹੈ ਇਹ ਅਸ਼ਲੀਲ ਨਹੀਂ ਹੋਣਾ ਚਾਹੀਦਾ ਇਹਦੀ ਸਭ ਤੋਂ ਵੱਡੀ ਚੁਣੌਤੀ ਇਹੀ ਹੈ ਜੇ ਏਸ਼ ਇਹ ਅਸ਼ਲੀਲਤਾ ਵੱਲ ਜਾਂਦਾ ਹੈ ਉਥੋਂ ਇਹ ਗਲਤ ਹੈ ਡਾਂਸ ਇੱਕ ਆਪਣੇ ਮਨ ਪਰਚਾਵੇ ਲਈ ਹੋਣਾ ਚਾਹੀਦਾ ਹੈ ਇੱਕ ਕਲਾ ਦੇ ਰੂਪ ਵਿੱਚ ਹੋਣਾ ਚਾਹੀਦਾ ਚਲੋ ਕਲਾ ਪ੍ਰਦਰਸ਼ਨੀ ਦੇ ਰੂਪ ਵਿੱਚ ਵੀ ਹੋਣਾ ਚਾਹੀਦਾ ਪਰ ਇਸਨੂੰ ਅਸ਼ਲੀਲਤਾ ਤੋਂ ਦੂਰ ਰੱਖਣਾ ਚਾਹੀਦਾ ਜਿਵੇਂ ਕਿ ਅਸੀਂ ਸਟੇਜ ਡਾਂਸਰਾ ਦੀ ਦੇਖ ਲੈਂਦੇ ਹਾਂ ਉਹਨਾਂ ਨਾਲ ਆਏ ਦਿਨ ਨਵੀਆਂ ਘਟਨਾਵਾਂ ਜਿਹੜੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਪਰ ਅੱਜ ਕੱਲ੍ਹ ਜਿਹੜਾ ਡਾਂਸ ਦਾ ਕਿੱਤਾ ਉਹ ਮਤਲਬ ਕੋਰਿਓਗ੍ਰਾਫੀ ਹੋ ਗਈ ਫ਼ਿਲਮਾਂ 'ਚ ਗਾਣਿਆਂ ਦੀ ਹੋ ਗਈ ਦੇ ਰੂਪ ਵਿੱਚ ਮਤਲਬ ਇੱਕ ਵਧੀਆ ਕਰੀਅਰ ਦੇ ਰੂਪ ਵਿਚ ਅਸੀਂ ਜਾਣ ਸਕਦੇ ਹਾਂ ਹੁਣ ਬੜੇ ਬੜੇ ਕੋਰਿਓਗ੍ਰਾਫ਼ਰ ਹੋ ਗਏ ਸਰੋਜ ਖਾਨ ਹੋ ਗਈ ਰੈਮੋ ਡੀਸੂਜ਼ਾ ਹੋ ਗਿਆ ਫ਼ਰਾ ਖਾਨ ਇਹੋ ਜਿਹੇ ਕਈ ਅਸੀਂ ਮਤਲਬ ਕਿ ਬਹੁਤ ਪ੍ਰਸਿੱਧ ਕੋਰਿਓਗ੍ਰਾਫ਼ਰ ਹੋਏ ਨੇ ਜੋ ਆਪਣੇ ਡਾਂਸਿੰਗ ਲਈ ਜਾਣੇ ਜਾਂਦੇ ਨੇ ਧੰਨਵਾਦ